ਆਟੋ ਟਿਊਨ ਇੱਕ ਵੋਇਸ ਪ੍ਰੋਸਿਸਕ ਪ੍ਰੋਸਿਕਸ ਐਪ ਹੈ ਜੋ ਇੱਕ ਗਾਇਕ ਦੀ ਆਵਾਜ਼ ਵਿੱਚ ਪਿੰਚ ਨੂੰ ਠੀਕ ਕਰਨ ਅਤੇ ਵਧਾਉਣ ਲਈ ਅਲੋਕਰੋ ਦੀ ਟੈਕਨੋਲਜੀ ਦੀ ਵਰਤੋਂ ਕਰਦਾ ਹੈ ਇਹ ਸੰਗੀਤ ਨਿਰਮਾਤਾਵਾਂ ਅਤੇ ਰਿਕਾਰਡਿੰਗ ਕਲਾਕਾਰ ਲਈ ਪ੍ਰਸਿੱਧ ਸਾਧਨ ਹੈ